ਪਸ਼ੂਆਂ ਨੂੰ ਸਵੇਰੇ ਸਵੇਰੇ ਅਸੀਂ ਪਹਿਲਾਂ ਉਹਨਾਂ ਨੂੰ ਉੱਠਦੇ ਹਾਂ ਪਹਿਲਾਂ ਉਹਨਾਂ ਨੂੰ ਅਸੀਂ ਬੜੇ ਪਿਆਰ ਦੇ ਨਾਲ ਪਲੋਸਦੇ ਹਾਂ ਤਾਂ ਕਿ ਉਹਨਾਂ ਨੂੰ ਮਤਲਬ ਅੱਛਾ ਅੱਛਾ ਬਹੁਤ ਵਧੀਆ ਲੱਗੇ ਕਿਉਂਕਿ ਪਸ਼ੂ ਵੀ ਆਪਣੇ ਬੱਚਿਆਂ ਦੇ ਬਰਾਬਰ ਹੁੰਦੇ ਹਨ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਵਾਂਗੂੰ ਹੀ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਅਸੀਂ ਪਿਆਰ ਨਾਲ ਪਲੋਸਦੇ ਹਾਂ ਫਿਰ ਉਹਨਾਂ ਨੂੰ ਅਸੀਂ ਥੋੜ੍ਹਾ ਹਰਾ ਹਰਾ ਘਾਹ ਪਾਂਦੇ ਹਾਂ ਖਾਣ ਮਤਲਬ ਥੋੜ੍ਹਾ ਜਿਹਾ ਉਹ ਖਾ ਕੇ ਥੋੜ੍ਹਾ ਜਿਹਾ ਉਹ ਫਰੈਸ਼ ਹੋ ਜਾਣ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਉਹਨਾਂ ਦਾ ਅਸੀਂ ਦੁੱਧ ਦੀਆਂ ਧਾਰਾਂ ਕੱਢਨੀਆਂ ਹੁੰਦੀਆਂ ਹਨ ਦੁੱਧ ਦੀਆਂ ਧਾਰਾਂ ਕੱਢਣ ਲਈ ਵੀ ਸਾਨੂੰ ਉਹਨਾਂ ਨੂੰ ਬਹੁਤ ਪਲੋਸਣਾ ਪੈਂਦਾ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਾਨੂੰ ਰੱਖਣਾ ਪੈਂਦਾ ਹੈ ਤਾਂ ਕਿ ਫਿਰ ਤਾਂ ਹੀ ਅਸੀਂ ਉਸ ਦੀਆਂ ਦੁੱਧ ਦੀਆਂ ਧਾਰਾਂ ਕੱਢਦੇ ਹਾਂ ਦੁੱਧ ਦੀਆਂ ਧਾਰਾਂ ਕੱਢਣ ਲਈ ਸਾਨੂੰ ਪਹਿਲਾਂ ਉਹਨਾਂ ਦੇ ਥਣਾਂ ਨੂੰ ਪਲੋਸਨਾ ਪੈਂਦਾ ਹੈ ਅਤੇ ਫਿਰ ਅਸੀਂ ਉਸ ਤੋਂ ਬਾਅਦ ਉਹਨਾਂ ਦਾ ਦੁੱਧ ਕੱਢਦੇ ਹਾਂ ਫਿਰ ਅਸੀਂ ਉਹਨਾਂ ਨੂੰ ਮਤਲਬ ਥੋੜ੍ਹੀ ਦੇਰ ਨੂੰ ਜੇ ਗਰਮੀਆਂ ਵਿੱਚ ਹੋਣ ਗਰਮੀਆਂ ਹੋਣ ਫਿਰ ਉਹਨਾਂ ਨੂੰ ਅਸੀਂ ਥੋੜ੍ਹੀ ਦੇਰ ਬਾਹਰ ਘੁਮਾ ਕੇ ਲਿਆਂਦੇ ਹਾਂ ਉੱਥੇ ਉਹਨਾਂ ਨੂੰ ਮਤਲਬ ਥੋੜ੍ਹੀ ਦੇਰ ਖੁੱਲੇ ਪਾਣੀ ਜੇ ਹੋਵੇ ਉੱਥੇੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਵਾਉਂਦੇ ਵੀ ਹਾਂ ਅਤੇ ਮਤਲਬ ਉਹਨਾਂ ਨੂੰ ਪੂਰਾ ਉਹਨਾਂ ਨੂੰ ਘੁੰਮਾ ਫਿਰਾ ਕੇ ਫਿਰ ਅਸੀਂ ਉਹਨਾਂ ਨੂੰ ਘਰ ਲੈ ਆਉਂਦੇ ਹਾਂ ਅਤੇ ਘਰ ਦੇ ਗਰਮੀਆਂ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਪ ਗਰਮੀਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦਾ ਵੀ ਪੂਰਾ ਬੰਦੋਬਸਤ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਪਸ਼ੂਆਂ ਨੂੰ ਗਰਮੀ ਨਾ ਲੱਗੇ ਅਤੇ ਉਹਨਾਂ ਨੂੰ ਮਤਲਬ ਗਰਮੀਆਂ ਦੇ ਵਿੱਚ ਵੀ ਉਹਨਾਂ ਦਾ ਪੂਰਾ ਧਿਆਨ ਰੱਖਦੇ ਹਾਂ ਜੇ ਸਰਦੀਆਂ ਹੋਣ ਤਾਂ ਉਹਨਾਂ ਦੇ ਉੱਪਰ ਜਿਵੇਂ ਅਸੀਂ ਤਰਪਾਲ ਵਗੈਰਾ ਪਾ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਸਰਦੀਆਂ 'ਚ ਵੀ ਉਹਨਾਂ ਦਾ ਪੂਰਾ ਬਚਾਅ ਰਵੇ ਅਤੇ ਗਰਮੀਆਂ 'ਚ ਵੀ ਉਹਨਾਂ ਦਾ ਪੂਰਾ ਬਚਾਅ ਰਵੇ ਫਿਰ ਅਸੀਂ ਉਹਨਾਂ ਨੂੰ ਦੁਪਹਿਰੇ ਜਿਵੇਂ ਖਲ ਵਗੈਰਾ ਤੂੜੀ ਉਹਨਾਂ ਨੂੰ ਮਤਲਬ ਉਹ ਉਹਨੂੰ ਖਾਣ ਵਾਸਤੇ ਉਹਨਾਂ ਦਾ ਤਾਂ ਖਾਣਾ ਉਹੀ ਹੁੰਦਾ ਹੈ ਅਸੀਂ ਉਹਨਾਂ ਨੂੰ ਖਾਣ ਵਾਸਤੇ ਖਲ ਵੜੇਵੇਂ ਵਗੈਰਾ ਇੱਦਾਂ ਦੀਆਂ ਚੀਜ਼ਾਂ ਪਾਉਂਦੇ ਹਾਂ ਅਤੇ ਤਾਂ ਕਿ ਉਹਨਾਂ ਨੂੰ ਮਤਲਬ ਭੁੱਖ ਉਹਨਾਂ ਦੀ ਦਾ ਪੂਰਾ ਬੰਦੋਬਸਤ ਕੀਤਾ ਜਾਂਦਾ ਹੈ ਫਿਰ ਉਹਨਾਂ ਨੂੰ ਅਸੀਂ ਪਾਣੀ ਜਦੋਂ ਦੁਪਹਿਰ ਦੇ ਟਾਈਮ 'ਤੇ ਗਰਮੀ ਹੋਵੇ ਉਦੋਂ ਫਿਰ ਅਸੀਂ ਉਹਨਾਂ ਨੂੰ ਦੁਪਹਿਰ ਟੈਮ 'ਤੇ ਪੂਰਾ ਖਲ ਦੇ ਵਿੱਚ ਪਾਣੀ ਵੀ ਉਹਨਾਂ ਦੇ ਪੂਰਾ ਬਣਾਇਆ ਹੁੰਦਾ ਅਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਵਿੱਚ ਪਾਣੀ ਪਾ ਕੇ ਰੱਖਦੇ ਹਾਂ ਤਾਂ ਕਿ ਜਦੋਂ ਵੀ ਉਹਨਾਂ ਨੂੰ ਪਿਆਸ ਲੱਗੇ ਤਾਂ ਉਹ ਆਪਣਾ ਖੁੱਲਾ ਡੁੱਲਾ ਪਾਣੀ ਪੀ ਸਕਣ ਅਤੇ ਉਹਨਾਂ ਦਾ ਮਤਲਬ ਹਰ ਕਿਸੇ ਪਾਸਿਓਂ ਵੀ ਮਤਲਬ ਉਹਨਾਂ ਨੂੰ ਪੂਰਾ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਨਾ ਚਾਹੀਦਾ ਕਿਉਂਕਿ ਸਾਨੂੰ ਮੱਝਾਂ ਸਾਨੂੰ ਪੂਰਾ ਆਪਣਾ ਦੁੱਧ ਦਿੰਦੀਆਂ ਹਨ ਅਤੇ ਇਹ ਦੁੱਧ ਅਸੀਂ ਆਪਣੇ ਬੱਚਿਆਂ ਨੂੰ ਵੀ ਪਿਆਣਾ ਹੁੰਦਾ ਖੁਦ ਵੀ ਪੀਣਾ ਹੁੰਦਾ ਅਤੇ ਇਸ ਕਰਕੇ ਅਸੀਂ ਉਹਨਾਂ ਦਾ ਪੂਰਾ ਧਿਆਨ ਰੱਖਦੇ ਹਾਂ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਉਹਨਾਂ ਦੇ ਖਾਣ ਪੀਣ ਦਾ ਹਰਾ ਛਟਾਲਾ ਪਾਂਦੇ ਹਾਂ ਹਰਾ ਘਾਹ ਪਾਂਦੇ ਹਾਂ ਅਤੇ ਜੋ ਵੀ ਉਹਨਾਂ ਦਾ ਜੋ ਜੋ ਉਹਨਾਂ ਦੀਆਂ ਖਾਣ ਦੀਆਂ ਚੀਜ਼ਾਂ ਵੜੇਵੇਂ ਵ ਵੰਡ ਵੜੇਵੇਂ ਸਾਰਾ ਕੁਝ ਉਹਨਾਂ ਨੂੰ ਪਾਂਦੇ ਹਾਂ ਅਤੇ ਉਹਨਾਂ ਨੂੰ ਘੁਮਾਉਣ ਦੇ ਟਾਈਮ 'ਤੇ ਘੁਮਾਉਣ ਲੈ ਕੇ ਜਾਂਦੇ ਹਾਂ ਖਾਣ ਦੇ ਟਾਈਮ 'ਤੇ ਖਾਣ ਦਿੰਦੇ ਹਾਂ ਸ਼ਾ ਅਤੇ ਇਹੀ ਉਹਨਾਂ ਦੀ ਮੇਨ ਰੂਟੀਨ ਹੁੰਦੀ ਹੈ